ਜੇਕਰ ਮੈਂ ਦੱਸਾਂ ਤਾਂ ਸੈਲਫ ਹੈਲਪ ਗਰੁੱਪ ਜੋ ਕਿ ਪੂਰੇ ਹੀ ਭਾਰਤ ਵਿੱਚ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹ ਲੋਕਾਂ ਨੂੰ ਉਹਨਾਂ ਦੀ ਉਹਨਾਂ ਦੇ ਚੰਗੀ ਸਿਹਤ ਅਤੇ ਹੋਰ ਚੀਜ਼ਾਂ ਬਾਰੇ ਹਮੇਸ਼ਾ ਹੀ ਜਾਗਰੂਕ ਕਰਦਾ ਰਹਿੰਦਾ ਹੈ ਸਾਨੂੰ ਤੁਹਾਨੂੰ ਇਹਨਾਂ ਤੋਂ ਹਮੇਸ਼ਾ ਹੀ ਅਲੱਗ ਅਲੱਗ ਚ ਚੀਜ਼ਾਂ ਬਾਰੇ ਪਤਾ ਚੱਲਦਾ ਹੈ ਕਿ ਸਰਕਾਰ ਦੁਆਰਾ ਸਾਡੇ ਲਈ ਕੀ ਕੀ ਸੁਵਿਧਾਵਾਂ ਬਣਾਈਆਂ ਗਈਆਂ ਹਨ ਅਤੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਜਿਵੇਂ ਕਿ ਪੰਜਾਬ ਵਿੱਚ ਵੀ ਆਪ ਸਰਕਾਰ ਨੇ ਕਾਫ਼ੀ ਵਧੀਆ ਸਹੂਲਤਾਵਾਂ ਪ੍ਰਾਪਤ ਕਰਾਈਆਂ ਹਨ ਜਿਸ ਨਾਲ ਕਿ ਸਾਡੀ ਪਰ ਸਾਨੂੰ ਸਿਹਤ ਅਤੇ ਹੋਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਘਰ ਬੈਠੇ ਹੀ ਪ੍ਰਾਪਤ ਹੁੰਦੀਆਂ ਹਨ ਜੇਕਰ ਅਸੀਂ ਔਰਤਾਂ ਦੇ ਰੁਜ਼ਗਾਰ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਔਰਤਾਂ ਕਿਸੇ ਵੀ ਕੰਮ ਕਿਸੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਸਕਦੀਆਂ ਹਨ ਉਹ ਘਰ ਬੈਠੇ ਹੀ ਅਲੱਗ ਅਲੱਗ ਤਰ੍ਹਾਂ ਦਾ ਕੰਮ ਸ਼ੁਰੂ ਕਰ ਸਕਦੀਆਂ ਹਨ ਜਿਵੇਂ ਕਿ ਬੱਚਿਆਂ ਨੂੰ ਪੜ੍ਹਾਉਣਾ ਕੁਝ ਖਾਣਾ ਬਣਾਉਣਾ ਸਵਿਗੀ ਜਮੈਟੋ ਵਗੈਰਾ 'ਤੇ ਕਾਫ਼ੀ ਕੁਝ ਵਿਕ ਰਿਹਾ ਹੈ ਅਤੇ ਉਹ ਉਹਨਾਂ ਦੇ ਰੁਜ਼ਗਾਰ ਲਈ ਕੋਈ ਵੀ ਕਮੀ ਨਹੀਂ ਹੈ ਉਹ ਕੁਝ ਵੀ ਕੰਮ ਕਰ ਸਕਦੀਆਂ ਹਨ